ਹਾਂਜੀ ਉਹ ਅਸੀਂ ਕਹਿੰਦੇ ਇਹਨਾਂ ਨੂੰ ਵੀ ਬੱਚਿਆਂ ਨੂੰ ਅਖਬਾਰ ਪੜ੍ਹਿਆ ਕਰੋ ਅਸੀਂ ਵੀ ਪੜ੍ਹੀ ਦੀ ਉਹਦੇ ਵਿੱਚ ਬਹੁਤ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਮਹਾਂਮਾਰੀ ਬਾਹਰਲੇ ਦੇਸ਼ਾਂ ਦੇ ਜੋ ਵੀ ਹੁੰਦਾ ਸਭ ਕੁਛ ਪਤਾ ਘਟਨਾਵਾਂ ਹੁੰਦੀਆਂ ਪਤਾ ਲੱਗ ਜਾਂਦਾ ਪਿੱਛੇ ਵੀ ਕਰੋਨਾ ਆਇਆ ਸੀ ਉਸ ਬਾਰੇ ਵੀ ਸਾਰਾ ਕੁਛ ਜਾਣਕਾਰੀ ਮਿਲੀ ਸੀ ਤਾਂ ਉਹ ਵਿੱਚ ਹੋਰ ਸਾਰੇ ਖਬਰ ਬਣਦੀ ਹੈ ਜੋ ਵੀ ਦਵਾਈਆਂ ਦਵੂਈਆਂ ਦਾਰਾਂ ਦਾ ਉਹ ਵੀ ਪਤਾ ਲੱਗ ਜਾਂਦਾ ਖੇਤਾਂ ਖੁਤਾਂ 'ਚ ਜਿਹੜੀ ਪਾਉਂਦੇ ਸਭ ਕੁਛ ਹੁੰਦੀ ਖਬਰ ਵਿੱਚ ਹੋਰ ਜੋ ਵੀ ਅ ਖ ਆਉਂਦਾ ਬਾਹਰ ਕਈ ਨਸ਼ਿਆਂ ਬਾਰੇ ਕੋਈ ਸਭ ਆਹਾ ਸਭ ਬਾਰੇ ਪਤਾ ਲੱਗ ਜਾਂਦਾ ਅੱਜ ਕੱਲ੍ਹ ਬਹੁਤ ਸਾਰੀਆਂ ਖਬਰਾਂ ਆਉਂਦੀਆਂ ਆ ਕੋਈ ਨਾ ਕੋਈ ਪਤਾ ਲੱਗਦਾ ਹੀ ਆ ਇਹਨਾਂ ਨੂੰ ਅਸੀਂ ਤਾਂ ਸਾਰਿਆਂ ਨੂੰ ਕਹੀਦਾ ਆਪਣੇ ਰਿਸ਼ਤੇਦਾਰਾਂ ਨੂੰ ਵੀ ਕਹੀਦਾ ਵੀ ਅਖਬਾਰ ਪੜ੍ਹਿਆ ਕਰੋ ਹੋਰ ਬਾਕੀ ਅਸੀਂ ਵੀ ਪੜ੍ਹੀ ਦੀ ਹੈ ਜਦੋਂ ਟਾਈਮ ਲੱਗਦਾ ਕੰਮ ਕਰਕੇ ਪੜ੍ਹ ਲਈਦੀ ਆ ਇਹਨਾਂ ਨੂੰ ਬੱਚਿਆਂ ਨੂੰ ਵੀ ਇਹੀ ਕਹੀਦਾ ਵੀ ਪੜ੍ਹਿਆ ਕਰੋ ਹੋਰ ਵੀ ਆਪਣਿਆਂ ਸਾਰਿਆਂ ਨੂੰ ਕਹੀਦਾ ਪਤਾ ਲੱਗੇ ਸਾਰਿਆਂ ਨੂੰ ਬਹੁਤ ਬਹੁਤ ਤੁਹਾਡਾ ਧੰਨਵਾਦ